ਸਰ ਸਤਿ ਸ਼੍ਰੀ ਅਕਾਲ ਜੀ ਸਰ ਅਰਜਨ ਢਿੱਲੋਂ ਬੋਲ ਰਹੇ ਆ ਸਰ ਅਸੀਂ ਨਾ ਬਠਿੰਡਾ ਤੋਂ ਬੋਲ ਰਹੇ ਸੀ ਤੋ ਆਪਣੇ ਨਾ ਸਰ ਬੇਟੇ ਦੀ ਨਾ ਮੈਰਿਜ ਹੈਗੀ ਤਾਂ ਅਸੀਂ ਤੁਹਾਡੀ ਬੁਕਿੰਗ ਕਰਵਾਉਣੀ ਸੀਗੀ ਜੀ ਕੀ ਤੁਸੀਂ ਫਰੀ ਹੋ ਜੀ ਬਾਈ ਤਰੀਕ ਨੂੰ ਹਾਂਜੀ ਮਾੜਾ ਜਿਹਾ ਚੈੱਕ ਕਰਕੇ ਦੱਸੋ ਸਰ ਸਰ ਐਵੇਂ ਸੀ ਕਿ ਉਸ ਦਿਨ ਨਾ ਆਪਣੇ ਬੇਟੇ ਦੀ ਮੈਰਿਜ ਆ ਅਤੇ ਉੱਥੇ ਨਾ ਕਿ ਗਰੀਨ ਸਿਟੀ ਦੇ ਵਿੱਚ ਪੈਲਸ ਹੈਗਾ ਅਤੇ ਉੱਥੇ ਕਰਵਾਉਣੀ ਸੀ ਤਾਂ ਸਰ ਕੀ ਆਪਣਾ ਪੈਕੇਜ ਵਗੈਰਾ ਕੀ ਹੁੰਦਾ ਗਾ ਕਿਵੇਂ ਜੀ ਨਹੀਂ ਨਾਈਟ ਦਾ ਹੀ ਹੈ ਜੀ ਨਾਈਟ ਦੀ ਮੈਰਿਜ ਹੈ ਜੀ ਅਤੇ ਸਰ ਅਤੇ ਦੂਜੀ ਗੱਲ ਐਂ ਸੀਗੀ ਉਸ ਦਿਨ ਨਾ ਉਹ ਗਾਣਾ ਲਗਵਾਉਣਾ ਆਜਾ ਫੁੱਲ ਝੜੀਏ ਫਲਾਈ ਕਰਕੇ ਹਾਂਜੀ ਹਾਂਜੀ ਐਂ ਆ ਜੀ ਕਈ ਵਾਰੀ ਸ਼ਰਾਬੀ ਕਬਾਬੀ ਵੀ ਹੁੰਦੇ ਆ ਐਵੇਂ ਹੈ ਨਾ ਤੁਸੀਂ ਗੁੱਸਾ ਗਾਸਾ ਨਾ ਕਰਿਓ ਕਈ ਵਾਰ ਕੋਈ ਗੱਲਬਾਤ ਹੋ ਜਾਂਦੀ ਹਾਂਜੀ ਹਾਂਜੀ ਤਾਂ ਸਰ ਐਵੇਂ ਕਰਦੇ ਤੁਸੀਂ ਨੋਟ ਕਰ ਲਿਓ ਜੀ ਯਾਦ ਨਾਲ ਤੇ ਹੋਰ ਕੋਈ ਨਾ ਬੁੱਕ ਹੋ ਜਾਵੇ ਹਾਂ ਹਾਂ ਸਰ ਬਠਿੰ ਹਾਂਜੀ ਠੀਕ ਹੈ ਸਰ ਠੀਕ ਹੈ ਹਾਂਜੀ ਜ਼ਰੂਰ ਸਰ ਠੀਕ ਹੈ ਓਕੇ ਓਕੇ ਸਰ ਥੈਂਕ ਯੂ ਸਰ ਸੋ ਮੱਚ